ਅੱਜ ਦੀ ਦੁਨੀਆਂ ਵਿਕਾਸਸ਼ੀਲ ਦੀ ਦੁਨੀਆਂ ਹੈ ਵਿਕਾਸ ਦੇ ਨਾਲ ਨਾਲ ਸਾਡਾ ਸੰਸਾਰ ਵੀ ਕਾਫ਼ੀ ਵਿਕਾਸਸ਼ੀਲ ਹੋ ਰਿਹਾ ਹੈ ਵਿਕਾਸਸ਼ੀਲ ਸੰਸਾਰ ਕਾਫੀ ਬਦਲ ਰਿਹਾ ਹੈ ਅਤੇ ਇਸ ਦੇ ਨਾਲ ਨਾਲ ਸਾਡਾ ਜਿਹੜਾ ਕੰਮ ਹੈ ਉਹ ਵੀ ਮਿੰਟਾਂ ਸਕਿੰਟਾ ਦੇ ਵਿੱਚ ਹੋ ਰਿਹਾ ਹੈ ਪਹਿਲਾਂ ਜਿਸ ਕੰਮ ਨੂੰ ਕਰਨ ਲਈ ਇੱਕ ਇੱਕ ਘੰਟਾ ਅਤੇ ਕਈ ਵਾਰ ਕੁਝ ਦਿਨਾਂ ਦਾ ਸਮਾਂ ਵੀ ਲੱਗਦਾ ਸੀ ਹੁਣ ਉਹ ਕੰਮ ਕੁਝ ਹੀ ਸਕਿੰਟਾਂ ਜਾਂ ਘੰਟੇ ਦਾ ਹੀ ਰਹਿ ਗਿਆ ਹੈ ਪਹਿਲਾਂ ਲੋਕ ਇੰਨੀ ਦੂਰ ਤੋਂ ਚੱਲ ਕੇ ਆਉਂਦੇ ਸਨ ਪਰ ਅੱਜ ਕੱਲ੍ਹ ਦੀ ਤਕਨੀਕ ਨਾਲ ਸਾਡੇ ਕੋਲ ਬਾਈਕ ਈ ਰਿਕਸ਼ਾ ਅਤੇ ਗੱਡੀਆਂ ਦੀ ਸਹੂਲਤ ਹੋ ਗਈ ਹੈ ਜਿਸ ਦੇ ਕਾਰਨ ਲੋਕਾਂ ਨੂੰ ਦੂਰ ਜਾਣ ਦੀ ਪਰੇਸ਼ਾਨੀ ਨਹੀਂ ਹੁੰਦੀ ਇਸ ਦੇ ਨਾਲ ਨਾਲ ਆਹ ਸਾਰੀ ਚੀਜ਼ਾਂ ਸਾਨੂੰ ਘੱਟ ਰੇਟਾਂ 'ਤੇ ਵੀ ਮਿਲ ਜਾਂਦੀਆਂ ਹਨ ਜੇ ਕਿਸੇ ਕੋਲ ਗੱਡੀ ਗੱਡੀ ਲੈਣ ਦੇ ਪੈਸੇ ਨਹੀਂ ਹੈ ਤਾਂ ਉਹ ਬੱਸ ਵਿੱਚ ਸਫ਼ਰ ਕਰ ਸਕਦਾ ਹੈ ਉਹ ਵੀ ਘੱਟ ਰੇਟ ਦੇ ਵਿੱਚ ਜਿਸ ਨਾਲ ਆਹ ਸਾਰੀ ਸ ਸਾਨੂੰ ਸੁਖਾਲੀ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ ਵਿਕਾਸ ਜ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਸਾਨੂੰ ਨੌਕਰੀਆਂ ਵੀ ਦਵਾਉਂਦੀ ਹੈ ਅਤੇ ਸਾਡਾ ਕੰਮ ਵੀ ਬਹੁਤ ਜ਼ਿਆਦਾ ਸੁਖਾਲਾ ਕਰ ਦਿੰਦੀ ਹੈ ਹੁਣ ਅੱਜ ਕੱਲ੍ਹ ਸਾਰਾ ਕੰਮ ਕੰਪਿਊਟਰ ਲੈਪਟਾਪ ਅਤੇ ਇੰਟਰਨੈੱਟ ਦੇ ਰਾਹੀਂ ਹੋ ਜਾਂਦਾ ਹੈ ਜਿਹੜੇ ਕੰਮ ਦੀ ਪਹਿਲਾਂ ਫਾਈਲਾਂ ਤਿਆਰ ਕਰਨ ਲਈ ਇੰਨੇ ਬੰਦੇ ਲੱਗਦੇ ਸਨ ਉਸ ਲਈ ਹੁਣ ਇੱਕ ਬੰਦਾ ਕੰਪਿਊਟਰ ਅਤੇ ਇੰਟਰਨੈੱਟ ਲਈ ਚਾਹੀਦਾ ਹੈ ਅਤੇ ਅੱਜ ਕੱਲ੍ਹ ਕਾਫ਼ੀ ਸਾਰੀ ਮਸ਼ੀਨਾਂ ਦਾ ਵੀ ਇਜਾਦ ਹੋ ਰਿਹਾ ਹੈ ਜਿਹੜੀ ਸਾਨੂੰ ਆਉਣ ਜਾਣ ਅਤੇ ਸਾਡੀ ਮੈਡੀਕਲ ਫੈਸੀਲਿਟੀਆਂ ਵਿੱਚ ਵੀ ਸਾਡੀ ਮਦਦ ਕਰਦੀ ਹੈ